ਅਸੀਂ ਮੌਜੂਦਾ ਪੌਦਿਆਂ ਤੋਂ ਹੋਰ ਪੌਦਿਆਂ ਲਈ ਤਕਨੀਕ ਹੋਰ ਪੌਦੇ ਪੈਦਾ ਕਰਨ ਲਈ ਆਮ ਤਕਨੀਕ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਗੁਲਾਬ ਦਾ ਫੁੱਲ ਹੈ ਜੇਕਰ ਅਸੀਂ ਗੁਲਾਬ ਦੇ ਫੁੱਲ ਦੇ ਪੌਦੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਹੋਰ ਲਗਾਉਣਾ ਹੈ ਤਾਂ ਅਸੀਂ ਉਹਦੀ ਕਲਮ ਪੱਟ ਕੇ ਦੂਜੀ ਥਾਂ ਲਗਾ ਦਿੰਦੇ ਹਾਂ ਜਿਸ ਨਾਲ ਕਿ ਉਹ ਪੌਦਾ ਉੱਥੇ ਵੀ ਉੱਗ ਜਾਂਦਾ ਹੈ ਇਸ ਤੋਂ ਇਲਾਵਾ ਜਿਵੇਂ ਗੈਂਦੇ ਦੇ ਫੁੱਲ ਹਨ ਤਾਂ ਉਸ ਦੇ ਫੁੱਲਾਂ ਵਿੱਚੋਂ ਬੀਜ ਕੱਢ ਕੇ ਵੀ ਅਸੀਂ ਉਸਨੂੰ ਦੂਜੀ ਥਾਂ 'ਤੇ ਲਗਾਉਂਦੇ ਹਨ ਤਾਂ ਉੱਥੇ ਵੀ ਉਹ ਫੁੱਲ ਪੈਦਾ ਹੋ ਜਾਂਦਾ ਹੈ